ਗਰਮੀਆਂ ਅਤੇ ਸਰਦੀਆਂ ਵਿੱਚ ਪਸ਼ੂਆਂ ਦੀ ਦੇਖਭਾਲ ਲਈ ਚੰਗੇ ਪ੍ਰਬੰਧ ਹੋਣੇ ਚਾਹੀਦੇ ਹਨ ਜਿਵੇਂ ਕਿ ਗਰਮੀਆਂ ਵਿੱਚ ਹਵਾਦਾਰ ਕਮਰੇ ਹਵਾਦਾਰ ਸ਼ੈਡਾਂ ਅਤੇ ਸਾਫ ਸੁਥਰੀਆਂ ਮੱਛਰ ਮੱਖੀਆਂ ਤੋਂ ਬਚਾਅ ਵਾਸਤੇ ਚੰਗੀ ਤਰ੍ਹਾਂ ਸ਼ੈਡਾਂ ਨੂੰ ਸੈਨੀਟਾਈਜ ਕਰਨਾ ਜਰੂਰੀ ਹੈ ਤਾਂ ਜੋ ਕਿਸੇ ਕਿਸਮ ਦੇ ਕਿਟਾਣੂ ਵਗੈਰਾ ਸ਼ੈਡ ਵਿੱਚ ਨਾ ਪਾਏ ਜਾਣ ਅਤੇ ਬਰਸਾਤਾਂ ਵਿੱਚ ਫੰਗਸ ਦੋ ਬਚਾ ਲਈ ਪਸ਼ੂਆਂ ਦੇ ਫੀਡਰਾਂ ਨੂੰ ਚੰਗੀ ਤਰ੍ਹਾਂ ਸਾਫ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਇਹਨਾਂ ਵਿੱਚ ਕੋਈ ਵੀ ਫੰਗਸ ਨਾ ਪਵੇ ਤੇ ਪਸ਼ੂਆਂ ਦੀ ਸਰੀਰਿਕ ਸਾਂਭ ਸੰਭਾਲ ਵੀ ਜਰੂਰੀ ਹੈ ਅਤੇ ਸਰਦੀਆਂ ਵਿੱਚ ਸ਼ੈਡ ਨੂੰ ਚੰਗੀ ਤਰ੍ਹਾਂ ਕਵਰ ਕੀਤਾ ਜਾਵੇ ਤਾਂ ਜੋ ਠੰਡ ਪਸੂਆਂ ਨੂੰ ਨਾ ਲੱਗੇ ਤਾਂ ਜਾਓ ਤਾਂ ਜੋ ਉਹ ਜਲਦੀ ਬਿਮਾਰ ਨਾ ਹੋਣ ਧੰਨਵਾਦ